ਹਰ ਵਿਅਕਤੀ ਦੇ ਆਪਣੇ ਨਿੱਜੀ ਟੀਚੇ ਅਤੇ ਇੱਛਾਵਾਂ ਹੁੰਦੀਆਂ ਹਨ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੈ ਜਿਸ ਜਿਸ ਕਰਕੇ ਉਹ ਨਿੱਜੀ ਟੀਚੇ ਰੱਖਣ ਦੇ ਨਾਲ ਆਪਣੀਆਂ ਹਰ ਇੱਕ ਇੱਛਾਵਾਂ ਨੂੰ ਪੂਰੀਆਂ ਕਰ ਸਕਦਾ ਹੈ ਅਤੇ ਮੇਰਾ ਇਹ ਟੀਚਾ ਹੈ ਕਿ ਮੈਂ ਇੱਕ ਬਿਜ਼ਨਸ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਮੈਨੂੰ ਸਿਲਾਈ ਕਢਾਈ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਅਤੇ ਮੈਂ ਇਸ ਨੂੰ ਆਪਣਾ ਬਿਜ਼ਨਸ ਬ ਬਣਾਉਣਾ ਚਾਹੁੰਦੀ ਹਾਂ ਅਤੇ ਮੈਨੂੰ ਇਹ ਕਰਨਾ ਬਹੁਤ ਪਸੰਦ ਹੈ ਇਸ ਨੂੰ ਪ੍ਰਾਪਤ ਕਰਨਾ ਮੈਨੂੰ ਲੱਗਦਾ ਹੈ ਕਿ ਮੇਰਾ ਇੱਕ ਟੀਚਾ ਆਪਣੀ ਜ਼ਿੰਦਗੀ ਦੇ ਵਿੱਚ ਹੈ ਤੋਂ ਤਾਂ ਮੈਂ ਇਹ ਪ੍ਰਾਪਤ ਜ਼ਰੂਰ ਕਰਾਂਗੀ